ਸਤਿ ਸ਼੍ਰੀ ਅਕਾਲ ਜੀ ਮੈਂ ਆਪ ਜੀ ਨੂੰ ਇੱਕ ਬੇਨਤੀ ਕਰਦੀ ਹਾਂ ਜੀ ਕੂੜਾ ਕਮੇਟੀ ਪ੍ਰਬੰਧਕ ਜੀ ਨੂੰ ਮੇਰੇ ਵੱਲੋਂ ਬੇਨਤੀ ਹੈ ਜੀ ਸਾਡੇ ਘਰ ਦੇ ਲਾਗੇ ਇੱਕ ਬਹੁਤ ਹੀ ਵੱਡਾ ਮਲਬਾ ਪਿਆ ਹੋਇਆ ਹੈ ਬਹੁਤ ਹੀ ਜ਼ਿਆਦਾ ਉਹ ਸਾਡੇ ਘਰ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਤੇ ਪੂਰੇ ਮਹੱਲੇ ਵਿੱਚ ਉਸ ਨੇ ਮਲਬੇ ਨੇ ਬਹੁਤ ਜ਼ਿਆਦਾ ਗੰਦ ਪਾਇਆ ਹੋਇਆ ਹੈ ਸਾਰੇ ਮਹੱਲੇ ਦੇ ਲੋਕ ਬਹੁਤ ਪਰੇਸ਼ਾਨ ਹੈ ਇੱਥੋਂ ਤੱਕ ਕਿ ਕੁੱਤੇ ਵੀ ਆ ਕੇ ਉੱਥੇ ਪਿਸ਼ਾਬ ਕਰ ਜਾਂਦੇ ਹਨ ਅਤੇ ਕਈ ਵਾਰ ਤਾਂ ਉੱਥੇ ਇੰਨੀ ਕੁ ਜ਼ਿਆਦਾ ਸਮੈਲ ਆਉਂਦੀ ਹੈ ਕਿ ਨੱਕ ਦੇਣਾ ਮੁਸ਼ਕਿਲ ਹੋ ਗਿਆ ਹੈ ਬਹੁਤ ਮੱਛਰ ਇਕੱਠਾ ਹੋ ਜਾਂਦਾ ਹੈ ਘਰ ਦੇ ਵਿੱਚ ਜਦੋਂ ਬਾਰਿਸ਼ ਆਉਂਦੀ ਤਾਂ ਪਾਣੀ ਇਕੱਠਾ ਹੋ ਜਾਂਦਾ ਹੈ ਇੱਥੋਂ ਤੱਕ ਕਿ ਕਈ ਲੋਕ ਉਹਦੇ ਵਿੱਚ ਆ ਕੇ ਲੁਕ ਜਾਂਦੇ ਆ ਅਤੇ ਚੋਰੀਆਂ ਕਰ ਲੈਂਦੇ ਹਨ ਅਤੇ ਆਂਢੀ ਗੁਆਂਢੀ ਵੀ ਬਹੁਤ ਜ਼ਿਆਦਾ ਤੰਗ ਆਏ ਹੋਏ ਹਨ ਬੱਚੇ ਵੀ ਬਹੁਤ ਜ਼ਿਆਦਾ ਬਿਮਾਰ ਹੋਣ ਲੱਗ ਪਏ ਹੈ ਸਿਹਤ 'ਤੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਅੱਜ ਕੱਲ੍ਹ ਜਿਵੇਂ ਮਹਾਈ ਦੇਵੇ ਮਹਿੰਗਾਈ ਦੇ ਵਿੱਚ ਜਾ ਤਾਂ ਬੰਦਾ ਰੋਟੀ ਖਾ ਲਏ ਅਤੇ ਜਾਂ ਦਵਾਈਆਂ ਖਾ ਲਏ ਕੀ ਕਰੀਏ ਮਲਬੇ ਤੋਂ ਕਾਰਨ ਸਾਡੇ ਘਰ ਵਿੱਚ ਤਾਂ ਕਲੇਸ਼ ਪਿਆ ਹੋਇਆ ਹੈ ਬੱਚੇ ਕਹਿੰਦੇ ਆ ਕਿ ਇਸ ਘਰ ਨੂੰ ਦਬਾਦਬ ਬਦਲ ਕੇ ਦੂਜਾ ਘਰ ਲਿਆ ਜਾਏ ਲੇਕਿਨ ਬਹੁਤ ਜ਼ਿਆਦਾ ਪੈਸੇ ਦੀ ਪ੍ਰੋਬਲਮ ਕਰਕੇ ਅਸੀਂ ਘਰ ਵੀ ਨਹੀਂ ਛੱਡ ਕੇ ਜਾ ਸਕਦੇ ਅਤੇ ਅਸੀਂ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਾਡੇ ਸਾਨੂੰ ਅਸੀਂ ਕੀ ਕਰੀਏ ਹੁਣ ਅਸੀਂ ਬੇਨਤੀ ਹੀ ਕਰ ਸਕਦੇ ਹਾਂ ਜੀ ਕਿਰਪਾ ਕਰਕੇ ਸਾਡੇ ਘਰ ਦੇ ਲਾਗਿਓਂ ਮਲਬਾ ਉਠਾਇਆ ਜਾਏ ਅਤੇ ਤੁਹਾਡੇ ਅੱਗੇ ਬੇਨਤੀ ਹੈ ਕੀ ਛੇਤੀ ਤੋਂ ਛੇਤੀ ਸਾਡੀ ਅਰਜ਼ੀ ਦੀ ਸੁਣਵਾਈ ਕੀਤੀ ਜਾਏ